ਅਸੀਂ ਆਪਣੇ ਆਲੇ ਦੁਆਲੇ ਬਗੀਚਿਆਂ ਵਿੱਚ ਬਹੁਤ ਸਾਰੇ ਫੁੱਲ ਪੌਦੇ ਲਗਾਉਂਦੇ ਹਾਂ ਅਤੇ ਦਰੱਖਤ ਵੀ ਲਗਾਉਂਦੇ ਹਾਂ ਜਦੋਂ ਉਹ ਹੌਲੀ ਹੌਲੀ ਵੱਡੇ ਹੁੰਦੇ ਹਨ ਅਤੇ ਫੁੱਲ ਉੱਗਦੇ ਹਨ ਸਾਨੂੰ ਦੇਖ ਕੇ ਬਹੁਤ ਹੀ ਖੁਸ਼ੀ ਮਹਿਸੂਸ ਹੁੰਦੀ ਹੈ ਸਕੂਨ ਮਿਲਦਾ ਹੈ ਅਤੇ ਚਾਰੇ ਪਾਸੇ ਹਰਿਆਲੀ ਹੀ ਹਰਿਆਲੀ ਹੋ ਜਾਂਦੀ ਹੈ ਸਾਨੂੰ ਬਾਗ ਬਗੀਚਿਆਂ ਵਿੱਚ ਫੁੱਲ ਪੌਦੇ ਅਤੇ ਰੁੱਖ ਬ ਹੀ ਲਗਾਉਣੇ ਚਾਹੀਦੇ ਹਨ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਕਿ ਅਸੀਂ ਆਪਣੇ ਵਾਤਾਵਰਨ ਨੂੰ ਸਾਫ ਸੁਥਰਾ ਅਤੇ ਬਗੀਚਿਆਂ ਨੂੰ ਸੁੰਦਰ ਬਣਾ ਸਕੀਏ